ਹਾਂ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਤੁਸੀਂ ਬਰਨਾਲਾ ਸੈਕਰਡ ਹਾਰਟ ਸਕੂਲ ਤੋਂ ਗੱਲ ਕਰਦੇ ਜੀ ਹਾਂਜੀ ਅੱਛਾ ਅੱਛਾ ਸਰ ਨਾ ਇੱਥੇ ਮੇਰੀ ਮਾਸੀ ਦੇ ਬੱਚੇ ਪੜ੍ਹਦੇ ਨੇ ਤੁਹਾਡੇ ਸਕੂਲ ਦੇ ਕੋਲ ਸਕੂਲ ਦੇ ਵਿੱਚ ਪੜ੍ਹਦੇ ਨੇ ਟੈਨਥ ਕਲਾਸ ਦੇ ਵਿੱਚ ਨੇ ਹਾਂਜੀ ਸਰ ਮੈਂ ਵੀ ਸਿਕਸਥ ਕਲਾਸ ਦੇ ਵਿੱਚ ਐਡਮਿਸ਼ਨ ਲੈਣੀ ਸੀ ਤ ਤੁਹਾਡੇ ਸਕੂਲ ਦੇ ਵਿੱਚ ਹਾਂਜੀ ਸਰ ਮੈਂ ਚਲੋ ਵੀ ਪੜ੍ਹਾਈ ਤਾਂ ਸਾਰੇ ਸਕੂਲਾਂ 'ਚ ਇੱਕੋ ਜਿਹੀ ਹੁੰਦੀ ਆ ਹੈ ਨਾ ਵੀ ਐਕਸਟਰਾ ਜਿਹੜਾ ਤੁਸੀਂ ਐਕਟੀਵਿਟੀਜ਼ ਕੀ ਕੁਛ ਕਰਵਾਉਂਦੇ ਹੋਵੋਗੇ ਨਾਲ ਸਾਨੂੰ ਸਟੂਡੈਂਟਸ ਨੂੰ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਜੀ ਹਾਂਜੀ ਭੰ ਭੰਗੜਾ ਹਾਂਜੀ ਹਾਂਜੀ ਹਾਂਜੀ ਮੈਨੂੰ ਨਾ ਭੰਗੜੇ ਦਾ ਵੀ ਬਹੁਤ ਸ਼ੌਕ ਆ ਜੀ ਮੈਂ ਫਿਫਥ ਤੀਕਰ ਭੰਗੜਾ ਕੀਤਾ ਸੀਗਾ ਅਤੇ ਹੁਣ ਮੈਨੂੰ ਐਂ ਵੀ ਚਲੋ ਜਿਹੜੇ ਆਪਣੇ ਕੰਪੀਟੀਸ਼ਨ ਹੁੰਦੇ ਆ ਵੀ ਮੈਂ ਪਾਰਟੀਸੀਪੇਟ ਜੇ ਤੁਹਾਡੇ ਸਕੂਲ ਦਾ ਨਾਮ ਸੁਣਿਆ ਸੀ ਕਹਿੰਦੇ ਵੀ ਵਧੀਆ ਹੈਗਾ ਮੈਂ ਕਿਹਾ ਵੀ ਚੱਲ ਮੈਂ ਥ ਵੀ ਮੈਂ ਆਪਦੇ ਪੇਰੇਂਟਸ ਨਾਲ ਗੱਲ ਕੀਤੀ ਆ ਵੀ ਮੈਂ ਕਿਹਾ ਮੇਰੀ ਵੀ ਐਡਮਿਸ਼

ਹਾਂਜੀ ਹਾਂਜੀ

ਠੀਕ ਹੈ ਸਰ ਹਾਂਜੀ ਸਰ ਮੇਰਾ ਕਲਚਰਲ ਐਕਟੀਵਿਟੀ ਮੈਨੂੰ ਬਹੁਤ ਜ਼ਿਆਦਾ ਲਾਈਕ ਆ ਭੰਗੜਾ ਵਗੈਰਾ ਕੋਰੀਓਗਰਾਫੀ ਹਾਂਜੀ ਹਾਂਜੀ ਇੱਧਰ ਮੇਰਾ ਇੰਟਰਸਟ ਜ਼ਿਆਦਾ ਵਾ ਥੋੜ੍ਹਾ ਜਿਹਾ ਠੀਕ ਹੈ ਜੀ

ਜੀ ਜੀ ਓਕੇ ਜੀ ਠੀ ਠੀਕ ਹੈ ਸਰ ਫਿਰ ਮੈਂ ਆਪਦੇ ਪੇਰੈਂਟਸ ਨੂੰ ਪੁੱਛ ਕੇ ਨਾ ਅਤੇ ਨਾਲ ਲੈ ਕੇ ਜ਼ਰੂਰ ਆਊਂਗਾ ਸਰ ਮੈਂ ਸੈਚਰਡੇਅ ਸਰ ਅਸੀਂ ਹੰਡਿਆਏ ਰਹਿੰਦੇ ਹਾਂ ਜੀ

ਸਰ ਵੈਨ ਇੱਧਰ ਆਉਂਦੀ ਨਹੀਂ ਤੁਹਾਡੀ ਕਿ ਕਚਹਿਰੀ ਰੋਡ 'ਤੇ ਉੱਥੇ ਤੀਕਰ ਹੀ ਆਉਂਦੀ ਹੈਗੀ ਹਾਂ ਸਰ ਮੈਂ ਮੈਂ ਵੈਨ 'ਤੇ ਹੀ ਆਊਂਗਾ ਜੀ ਨਹੀਂ ਸਰ ਵੈਨ 'ਤੇ ਮੈਂ ਹਾਂਜੀ ਸਾਡੇ ਪੇਰੈਂਟਸ ਅਲਾਓ ਨਹੀਂ ਨਾ ਕਰਦੇ ਏਟੀਨ ਯੀਅਰ ਤੋਂ ਪਹਿਲਾਂ ਅਤੇ ਉਹ ਕਹਿੰਦੇ ਵੈਨ 'ਤੇ ਹੀ ਭੇਜਾਂਗੇ ਜੀ ਕਹਿੰਦੇ ਹਾਂਜੀ ਸਰ ਹਾਂਜੀ ਹਾਂਜੀ ਨੋ ਸਰ ਬਸ ਮੈਂ ਇਹੀ ਕਰਨਾ ਸੀਗਾ ਮੈਂ ਕਿਹਾ ਚਲੋ ਮੈਂ ਐਨਾ ਕੁ ਡਿਸਕਸ ਕਰ ਲਵਾਂ ਲਵ ਕਰਨ ਸ਼ਰਮਾ ਜੀ ਸੈਕਸ਼ਨ ਬੀ ਹੈ ਸਰ ਉਹਨਾਂ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਉਹਨਾਂ ਤੋਂ ਹੀ ਮੈਂ ਐਕਟੀਵਿਟੀ ਉਹ ਬਾਹਵਾ ਹੁੰਦੀਆਂ ਉਹਨਾਂ ਦੀ ਮੈਨੂੰ ਵਧੀਆ ਲੱਗਿਆ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਸਰ ਮੈਂ ਨਾ ਇੱਥੇ ਗੁਰੂ ਨਾਨਕ ਦੇਵ ਸਕੂਲ ਹੈਗਾ ਇੱਧਰ ਆਪਣਾ ਹੰਡਾਇਆ ਰੋਡ ਦੇ ਉੱਪਰ ਹੈਗਾ ਹੰਡਾਇਆ 'ਤੇ ਤਾਂ ਪਤਾ ਵਿਚਕਾਰ ਆ ਜਾਂਦਾ ਹੈਗਾ ਜੀ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਸਰ ਹਾਂਜੀ ਓਕੇ ਸਰ ਥੈਂਕ ਯੂ ਜੀ